ਭਾਰਤ ਦੇ ਲੋਕਾਂ ਦਾ ਜਿਹੜਾ ਮਨੋਰੰਜਨ ਦਾ ਸਾਧਨ ਆ ਜਾਂ ਮਨੋਰੰਜਨ ਉਦਯੋਗ ਕਹੀਏ ਇਹਦਾ ਵਿਕਾਸ ਹੈ ਜਿਹੜਾ ਇਹ ਪੀੜ੍ਹੀ ਦਰ ਪੀੜ੍ਹੀ ਕਹਿ ਲਓ ਜਾਂ ਸਮੇਂ ਸਮੇਂ 'ਤੇ ਕਹਿ ਲਓ ਬਦਲਦਾ ਗਿਆ ਜਿਵੇਂ ਪਹਿਲਾਂ ਲੋਕਾਂ ਦੇ ਵਿੱਚ ਪੰਜਾਬ ਦੀ ਗੱਲ ਕਰਾਂ ਮੈਂ ਤਾਂ ਲੋਕ ਗੀਤਾਂ ਦਾ ਬਹੁਤ ਵੱਡਾ ਰਿਵਾਜ਼ ਸੀ ਲੋਕ ਸਿੱਠਣੀਆਂ ਜਿਹੜੇ ਗੀਤ ਸੱਭਿਆਚਾਰ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਲੋਕਾਂ ਦਾ ਮਨੋਰੰਜਨ ਹੁੰਦਾ ਸੀਗਾ ਅਤੇ ਉਸ ਤੋਂ ਬਾਅਦ ਰੇਡੀਓ ਆਏ ਰੇਡੀਓ ਦੇ ਵਿੱਚ ਗੀਤ ਆਉਂਦੇ ਸੀ ਫੇਰ ਟੈਲੀਵਿਜ਼ਨ ਆ ਗਿਆ ਟੈਲੀਵਿਜ਼ਨ ਤੋਂ ਬਾਅਦ ਜਿਹੜੇ ਆ ਮਤਲਬ ਵੀਸੀਆਰ ਆਏ ਅਤੇ ਫੇਰ ਸਿਨੇਮੇ ਆਏ ਅੱਜ ਵੱਡੇ ਵੱਡੇ ਮੌਲ ਆ ਜਿਹੜੇ ਫੇਰ ਕਿਸੇ ਕੋਈ ਇੱਕ ਸਮਾਂ ਇਹੋ ਜਿਹਾ ਵੀ ਸੀ ਜਦੋਂ ਪੰਜਾਬੀ ਅਖਾੜੇ ਵੀ ਲੱਗਦੇ ਸੀ ਇਸੇ ਤਰ੍ਹਾਂ ਭਾਰਤ ਦੇ ਹੋਰ ਸੂਬਿਆਂ ਦੇ ਵਿੱਚ ਵੀ ਬਹੁਤ ਸਾਰੇ ਮਨੋਰੰਜਨ ਦਾ ਤਰੀਕੇ ਲੋਕਾਂ ਦੇ ਹੈਗੇ ਆ ਲੋਕਾਂ ਦੇ ਅੱਡ ਅੱਡ ਤਿਉਹਾਰ ਆ ਜਿਹੜੇ ਉਹਨਾਂ ਦੇ ਉੱਤੇ ਉਹ ਆਪਦੇ ਧਾਰਮਿਕ ਆਪਣੇ ਗੁਰੂਆਂ ਪੀਰਾਂ ਦੇਵੀ ਦੇਵਤਿਆਂ ਨੂੰ ਮਨਾਉਣ ਦੇ ਵਾਸਤੇ ਬਹੁਤ ਸਾਰੇ ਜਿਹੜੇ ਮਤਲਬ ਮਨੋਰੰਜਨ ਦੇ ਸੰਬੰਧ ਵਿੱਚ ਗੀਤ ਗਾਉਂਦੇ ਹੈ ਭਜਨ ਗਾਉਂਦੇ ਹੈ ਤਾਂ ਉਹਨਾਂ ਦਾ ਜਿਹੜਾ ਮਤਲਬ ਮਾਨਸਿਕ ਤੇ ਬੌਧਿਕ ਵਿਕਾਸ ਇਹਦੇ ਨਾਲ ਹੁੰਦਾ ਅਤੇ ਲੋਕ ਆਪਦੀ ਮਤਲਬ ਜਿਹੜੀ ਹੈ ਭਾਰਤੀ ਕੌਮ ਹੈ ਜਿਹੜੇ ਭਾਰਤ ਦੇ ਲੋਕਾਂ ਦਾ ਪਿਛੋਕੜ ਆ ਜਿਹੜਾ ਉਹਦੇ ਨਾਲ ਜੁੜੀਆਂ ਚੀਜ਼ਾਂ ਨੂੰ ਦੇਖਣਾ ਪਸੰਦ ਕਰਦੇ ਹੈ ਉਹਨਾਂ ਨੂੰ ਜਿਹੜਾ ਪੱਛਮੀ ਸੱਭਿਆਚਾਰ ਬਹੁਤਾ ਪਸੰਦ ਨਹੀਂ ਹੈ ਪਰ ਫਿਰ ਵੀ ਸਾਡੇ ਇੱਥੇ ਪੱਛਮੀ ਸੱਭਿਆਚਾਰ ਕਾਫੀ ਮਤਲਬ ਉਹ ਅਸਰ ਕਰ ਰਿਹਾ ਹੈ ਪਰ ਫਿਰ ਵੀ ਭਾਰਤ ਦੇ ਲੋਕਾਂ ਦੀ ਜਿਹੜੀ ਸੰਸਕ੍ਰਿਤੀ ਹੈ ਭਾਰਤ ਉਸ ਦੇ ਲੋਕ ਉਸ ਸੰਸਕ੍ਰਿਤੀ ਦੇ ਨਾਲ ਜੁੜਨਾ ਚਾਹੁੰਦੇ ਆ ਜਿਹੜੀ ਉਹਨਾਂ ਦੀ ਅਸਲ ਦੇ ਵਿੱਚ ਸੰਸਕ੍ਰਿਤੀ ਜਿਹੜੀ ਪਿਛਲੇ ਮਤਲਬ ਪੀੜ੍ਹੀ ਦਰ ਪੀੜ੍ਹੀ ਪੰਜ ਹਜ਼ਾਰ ਸਾਲ ਤੋਂ ਪੁਰਾਣੀ ਸੰਸਕ੍ਰਿਤੀ ਹੈ ਉਹਦੇ ਨਾਲ ਜੁੜੇ ਰਹਿਣਾ ਚਾਹੁੰਦੇ ਹੈ ਅਤੇ ਭਾਰਤ ਦੇ ਮਨੋਰੰਜਨ ਦੇ ਜਿਹੜੇ ਵਿਕਾਸ ਆ ਉਹ ਉਦਯੋਗ ਉਦਯੋਗਿਕ ਵਿਕਾਸ ਹੈ ਮਨੋਰੰਜਨ ਦਾ ਉਦਯੋਗ ਦਾ ਵਿਕਾਸ ਹੈ ਜਿਹੜਾ ਉਹ ਸਮੇਂ ਸਮੇਂ 'ਤੇ ਬਦਲਦਾ ਰਿਹਾ ਧੰਨਵਾਦ